ਯੋਗ ਵਿੱਚ ਮੈਂ ਅੱਜ ਤੋਂ ਕੁਛ ਸਾਲ ਪਹਿਲੇ ਨਾ ਮੈਂ ਇੱਕ ਕਿਸੇ ਦੀ ਵੀਡੀਓ ਦੇਖੀ ਸੀ ਜਾਂ ਕਿਸੇ ਦੀ ਅਖ਼ਬਾਰਾਂ 'ਚ ਪੜ੍ਹਿਆ ਸੀ ਅਖ਼ਬਾਰਾਂ ਪੜ੍ਹਿਆ ਸੀ ਕਿ ਇੱਕ ਕਾਸ਼ੀ ਦੇ ਵਿੱਚ ਕੋਈ ਬਜ਼ੁਰਗ ਹੈਗੇ ਹੈ ਪੰਡਿਤ ਹੈਗੇ ਆ ਉਹ ਨਾ ਸਵੇਰੇ ਇਸ ਤਰ੍ਹਾਂ ਹੀ ਤਿੰਨ ਚਾਰ ਵਜੇ ਯੋਗ ਕਰਦੇ ਆ ਅਤੇ ਉਹਨਾਂ ਦੀ ਉਮਰ ਹੈਗੀ ਇੱਕ ਸੌੌ ਪੱਚੀ ਸਾਲ ਉਹਨਾਂ ਨੂੰ ਪਿੱਛੇ ਰਾਸ਼ਟਰਪਤੀ ਕੋਲ ਅਵਾਰਡ ਵੀ ਮਿਲਿਆ ਤਾਂ ਅਵਾਰਡ ਵੀ ਮਿਲਿਆ ਇਸ ਤਰ੍ਹਾਂ ਹੀ ਮੈਂ ਹੋਰ ਵੀ ਜਿਹਨਾਂ ਨੂੰ ਯੋਗੀਆਂ ਨੂੰ ਦੇਖਦਾ ਸੀ ਜਿਹੜੇ ਰਿਸ਼ੀ ਮੁਨੀ ਜਾਂ ਯੋਗ ਕਰਦੇ ਜਾਂ ਕਿਤਾਬਾਂ ਪੜ੍ਹਦਾ ਸੀ ਉਥੋਂ ਪਤਾ ਲੱਗਦਾ ਸੀ ਵੀ ਵਾਕਿਆ ਜਿਹੜੀ ਯੋਗ ਆ ਨਾ ਯੋਗ ਸਾਰਿਆਂ ਨਾਲੋਂ ਵਧੀਆ ਅੱਛੀ ਚੀਜ਼ ਹੈਗੀ ਆ ਯੋਗ ਨਾਲ ਮੇਨ ਤਾਂ ਗਲਾ ਹੈਗਾ ਸਾਡਾ ਫਿਜ਼ੀਕਲੀ ਅਸੀਂ ਠੀਕ ਰਹਿੰਦੇ ਹਾਂ ਸਾਨੂੰ ਡਾਕਟਰਾਂ ਦੇ ਪੈਸੇ ਨਹੀਂ ਖਰਚਣੇ ਪੈਂਦੇ ਡਾਕਟਰਾਂ ਕੋਲ ਪੈਸੇ ਬਚਦੇ ਆ ਉਸੇ ਪੈਸੇ ਨਾਲ ਅਸੀਂ ਖਾਣਾ ਪੀਣਾ ਹੋਰ ਚੀਜ਼ਾਂ ਖਾ ਸਕਦੇ ਹਾਂ ਜਿੰਨ੍ਹਾਂ ਨਾਲ ਅਸੀਂ ਸਵੱਸਥ ਰਹੀਏ ਸ਼ਾਕਾਹਾਰ ਸ਼ਾਕਾਹਾਰ ਵੀ ਯੋਗਦਾ ਵੀ ਹਿੱਸਾ ਹੈ ਕਿ ਸ਼ਾਕਾਹਾਰ ਵੀ ਅਪਣਾਓ ਯੋਗ ਵੀ ਕਰੋ ਅਤੇ ਯੋਗ ਨਾਲ ਬੰਦਾ ਸਵੱਸਥ ਰਹਿੰਦਾ ਬਿਮਾਰੀਆਂ ਦੂਰ ਹੁੰ ਹੁੰਦੀਆਂ ਬਿਮਾਰੀਆਂ ਕੋਲ ਨਹੀਂ ਆਉਂਦੀਆਂ ਬੰਦਾ ਆਪਣੇ ਆਪ ਨੂੰ ਬੜਾ ਲਾਈਟ ਮਹਿਸੂਸ ਕਰਦਾ ਯੋਗ ਦੇ ਫਾਇਦੇ ਬੜੇ ਹਨ ਫਾਇਦੇ ਮੇਨ ਮੇਨ ਫਾਇਦਾ ਤਾਂ ਇਹੋ ਹੈ ਕਿ ਬੰਦਾ ਸਵੱਸਥ ਰਹਿੰਦਾ ਕਹਿੰਦੇ ਨਾ ਹੈਲਥ ਇਜ ਅਵੱਬ ਵੈਲਥ ਕਿ ਅ ਸਰੀਰ ਅਨ ਅਮੁਲਿਆ ਧਨ ਹੈ ਸਵੱਸਥ ਅਮੁਲਿਆ ਧਨ ਹੈ ਅਤੇ ਇਸ ਪਿੱਛੇ ਹਰ ਕਿਸੇ ਬੰਦੇ ਨੂੰ ਯੋਗ ਅਪਣਾਉਣਾ ਚਾਹੀਦਾ ਹੈ ਯੋਗ ਅਪਣਾਓ ਅਤੇ ਰੋਗ ਭਗਾਓ ਯੋਗ ਬੱਚੇ ਤੋਂ ਲੈ ਕੇ ਬੁੱਢੇ ਤੱਕ ਹਰ ਕਿਸੇ ਪ੍ਰਾਣੀ ਨੂੰ ਸਵੱਸਥ ਰੱਖਦਾ ਅਤੇ ਬੰਦ ਬੁੱਢੇ ਆਦਮੀ ਵੀ ਅਗਰ ਯੋਗ ਕਰਦਾ ਤਾਂ ਉਹਨੂੰ ਵੀ ਜਵਾਨ ਕਰ ਦਿੰਦਾ ਇਹਦੇ ਵਿੱਚ ਹਰ ਕਿਸੇ ਬੰਦੇ ਨੂੰ ਹਰ ਕਿਸੇ ਬੱਚੇ ਨੂੰ ਜਨਾਨੀਆਂ ਨੂੰ ਯੋਗ ਅਪਣਾਉਣਾ ਚਾਹੀਦਾ ਹੈ ਅਤੇ ਯੋਗ ਭਗਾਏ ਰੋਗ ਥੈਂਕ ਯੂ ਜੀ